ਮੇਰੇ ਮਨਪਸੰਦ ਪੰਜਾਬੀ ਕਵੀ ਦਾ ਨਾਮ ਹੈ ਬੁੱਲ੍ਹੇ ਸ਼ਾਹ ਉਹਨਾਂ ਦੀ ਲੋਕ ਪ੍ਰਸਿੱਧ ਕਵਿਤਾ ਦਾ ਨਾਮ ਹੈ ਬੁੱਲ੍ਹੇ ਕੀ ਜਾਨ ਇਹਨਾਂ ਦਾ ਲਿਖਣ ਦਾ ਢੰਗ ਮੈਨੂੰ ਬਹੁਤ ਪਸੰਦ ਹੈ ਮੇਰੇ ਨਾਲ ਨਾਲ ਮੇਰੇ ਦੋਸਤਾਂ ਨੂੰ ਵੀ ਬੁੱਲ੍ਹੇ ਸ਼ਾਹ ਦੀ ਕਵਿਤਾਵਾਂ ਬਹੁਤ ਪਸੰਦ ਹਨ ਬੁੱਲ੍ਹੇ ਸ਼ਾਹ ਜਿਸ ਤਰੀਕੇ ਨਾਲ ਆਪਣੀਆਂ ਕਵਿਤਾ ਲਿਖਦੇ ਹਨ ਜਿਸ ਤਰੀਕੇ ਨਾਲ ਉਹ ਰੱਬ ਦੇ ਬਾਰੇ ਜਾਂ ਫਿਰ ਹੀ ਹਿੰਸਾ ਦੇ ਬਾਰੇ ਲਿਖਦੇ ਹਨ ਉਹ ਮੈਨੂੰ ਬਹੁਤ ਪਸੰਦ ਹੈ ਮੈਂ ਇੰਨੀਆਂ ਇਹਨਾਂ ਦੀ ਕਵਿਤਾਵਾਂ ਨੂੰ ਬਹੁਤ ਮੰਨਦੀ ਹਾਂ ਅਤੇ ਜਦੋਂ ਵੀ ਮੈਨੂੰ ਟਾਈਮ ਲੱਗੇ ਮੈਂ ਉਦੋਂ ਇਹਨਾਂ ਦੀਆਂ ਕਵਿਤਾਵਾਂ ਜ਼ਰੂਰ ਪੜ੍ਹਦੀ ਹਾਂ